ਮੈਂ ਆਪਣੇ ਬੂਟ ਗੁਪਤਾ ਬ ਬੂਟ ਹਾਊਸ ਸਰਹੰਦ ਤੋਂ ਲਏ ਸਨ ਜੋ ਕਿ ਵਧੀਆ ਕੋਐਲਿਟੀ ਦੇ ਸਨ ਲੈਦਰ ਵਧੀਆ ਸੀ ਕੰਫਰਟੇਬਲ ਹਨ ਅਤੇ ਪਹਿਨਣ ਵਿੱਚ ਬਹੁਤ ਵਧੀਆ